ਕੀੜੇ ਮਕੌੜਿਆਂ ਦੇ ਡੰਗ ਖ਼ਾਸ ਕਰਕੇ ਜਦੋਂ ਮਧੂ ਮੱਖੀ ਦਾ ਡੰਗ ਵੱਜਦਾ ਵੈਸੇ ਤਾਂ ਫਸਟ ਪਰੇ ਆਪਾਂ ਨੂੰ ਵੀ ਹਸਪਤਾਲ ਜਾਂ ਕਿਸੇ ਨੇੜੇ ਦੇ ਡਾਕਟਰ ਕੋਲ ਜਾਣਾ ਚਾਹੀਦਾ ਪਰ ਫਿਰ ਵੀ ਅਸੀਂ ਕੁਛ ਕੁ ਨੇ ਜਿਹੜੇ ਘਰੇਲੂ ਉਪਚਾਰ ਆ ਉਹਨਾਂ ਦੇ ਮਦਦ ਦੇ ਨਾਲ ਇਹਦਾ ਜਿਹੜਾ ਮਧੂ ਮੱਖੀ ਦਾ ਡੰਗ ਹੁੰਦਾ ਇਹਦੀ 'ਚ ਜਿਹੜੀ ਸੋਜ ਆ ਜਾਂ ਇਹਦੀ ਐਨਰਜੀ ਉਹਨੂੰ ਘੱਟ ਕਰ ਸਕਦੇ ਹਾਂ ਤਾਂ ਸਭ ਤੋਂ ਜਿਹੜਾ ਆਮ ਅਤੇ ਸੌਖਾ ਮਿਲਣ ਵਾਲਾ ਇਹਦਾ ਤਰੀਕਾ ਹੈਗਾ ਉਹ ਹੈਗਾ ਡੰਗ ਵਾਲੀ ਥਾਂ ਦੇ ਉੱਪਰ ਲੋਹੇ ਨੂੰ ਰਗੜਨਾ ਇਹਦੇ ਵਿੱਚ ਅਸੀਂ ਜਿਵੇਂ ਪਿਡ ਆਮ ਹੀ ਜਿਹੜੇ ਪੰਜਾਬੀ ਆ ਕੜਾ ਪਾਉਂਦੇ ਹਾਂ ਹੈ ਨਾ ਤਾਂ ਅਸੀਂ ਕੜੇ ਨੂੰ ਰਗੜ ਸਕਦੇ ਹਾਂ ਜਾਂ ਸਾਡੇ ਕੋਲ ਕੋਈ ਸੇ ਕੋਈ ਚਾਬੀ ਹੈ ਜਾਂ ਕੋਈ ਲੋਹੇ ਦਾ ਹੋਰ ਵੀ ਕੋਈ ਵੀ ਸਾਡੇ ਨੇੜੇ ਤੇੜੇ ਚੀਜ਼ ਆ ਹੈ ਨਾ ਉਹਨੂੰ ਰਗੜ ਦਿੰਦੇ ਹਾਂ ਇਹਦੇ ਨਾਲ ਜਿਹੜੀ ਮਧੂ ਮੱਖੀ ਦੇ ਡੰਗ ਦੀ ਸੋਜ ਆ ਨਹੀਂ ਹੁੰਦੀ ਗੀ ਇਸ ਤੋਂ ਇਲਾਵਾ ਜਿਹੜਾ ਹੁੰਦਾ ਜਿਹੜਾ ਵੀ ਕਿਉਂਕਿ ਇਹ ਮ ਮਧੂਮੱਖੀ ਦਾ ਜਿਹੜਾ ਡੰਗ ਇਦੇ ਇਹਦੇ ਵਿੱਚ ਨਾ ਤੇਜ਼ਾਬੀ ਮਾਦਾ ਹੁੰਦਾ ਅਤੇ ਅਸੀਂ ਇਹਦੇ ਲਈ ਸਾਬਣ ਜਾਂ ਮਿੱਠੇ ਸੋਡਾ ਜਿਹੜਾ ਆਪਾਂ ਵਰਤਦੇ ਹਾਂ ਉਹਨੂੰ ਪਾਣੀ ਵਿੱਚ ਘੋਲ ਕੇ ਉਹਦੀ ਥਾਂ 'ਤੇ ਵੀ ਲਗਾ ਸਕਦੇ ਹਾਂ ਜਾਂ ਇਹ ਇਹ ਵੀ ਵਰਤ ਆਮ ਜਿ ਜਿਵੇਂ ਭਰਿੰਡ ਆ ਜਿਹੜਾ ਪੀਲੇ ਰੰਗ ਦਾ ਉਹਦਾ ਉਹਦਾ ਜਿਹੜਾ ਡੰਗ ਹੁੰਦਾ ਉਹਦੇ ਵਿੱਚ ਉਹ ਹੁੰਦਾ ਖਾਰਾ ਉਹਦੇ ਲਈ ਅਸੀਂ ਜਿਹੜੀਆਂ ਹੈਗੀਆਂ ਤੇਜ਼ਾਬੀ ਮਾਦੇ ਵਾਲੀਆਂ ਚੀਜ਼ਾਂ ਵਰਤ ਲੈਂਦੇ ਹਾਂ ਜਿਵੇਂ ਕਿ ਹੁੰਦੀ ਆ ਅ ਅਚਾਰ ਹੋ ਗਿਆ ਸਾਡੇ ਘਰਾਂ ਵਿੱਚ ਆਮ ਹੀ ਮਿਲ ਜਾਂਦਾ ਹੈ ਨਾ ਇਸ ਤੋਂ ਇਲਾਵਾ ਨਿੰਬੂ ਦਾ ਰਸ ਹੋ ਗਿਆ ਜਾਂ ਕੋਈ ਵੀ ਸਿਰਕਾ ਹੋ ਗਿਆ